ਬਦਲਦੇ ਮੌਸਮ ਤੇ ਖੇਤ ਖੇਤੀ 'ਤੇ ਅਸਰ ਦਾ ਗੱਲ ਕਰੀਏ ਤਾਂ ਪਿਛਲੇ ਸਮੇਂ ਵਿੱਚ ਸਾਡੇ ਅੱਖੀਂ ਦੇਖੀ ਗੱਲ ਹੈ ਕਿ ਸਤਲੁੱਜ ਰੀਵਰ ਵਿੱਚ ਬਹੁਤ ਹੀ ਜ਼ਿਆਦਾ ਪਾਣੀ ਆ ਗਿਆ ਸੀ ਜਿਸ ਨਾਲ ਕੀ ਆਲੇ ਦੁਆਲੇ ਦੀਆਂ ਸਾਰੀਆਂ ਫ਼ਸਲਾਂ ਖਤਮ ਹੋ ਗਈਆਂ ਤੀਆਂ ਪਾਣੀ ਵਿੱਚ ਡੁੱਬ ਗਈਆਂ ਤੀਆਂ ਇਸ ਨਾਲ ਕਿਸਾਨ ਜਿੱਠ ਕੋਈ ਨਜਿੱਠ ਨਹੀਂ ਸਕਦੇ ਕਿਉਂਕਿ ਇਹ ਕਿਸਾ ਅ ਸਰਕਾਰਾਂ 'ਤੇ ਡਿਪੈਂਡ ਕਰਦੇ ਆ ਸਰਕਾਰਾਂ ਜੇ ਅਗਰ ਮੌਕੇ ਟਾਈਮ ਰਹਿੰਦੇ ਹੀ ਕਿਸਾਨਾਂ ਨੂੰ ਚੇਤਾਵਨੀ ਦੇ ਸਕਦੇ ਆ ਕਿ ਇੱਥੇ ਇੰਨੇ ਪਾਣੀ ਆ ਰਹੇ ਛੱਡ ਰਹੇ ਆ ਕਿ ਉਹ ਮੌਕੇ ਰਹਿੰਦੇ ਆਪਣਾ ਖੇਤਾਂ ਦੀ ਬਾੜ ਕਰ ਸਕੀਏ ਕੁਛ ਕਵਰ ਕਰ ਸਕਦੇ ਆ ਉਹਨਾਂ ਨੂੰ ਤਾਂ ਕਰਕੇ ਕ ਕ ਕਿਸਾਨ ਨੇ ਆਪਣੇ ਫ਼ਸਲਾਂ ਨੂੰ ਬਚਾ ਸਕਦੇ ਆ ਇਹ ਸਰ ਸਰਕ ਸਰਕਾਰਾਂ 'ਤੇ ਡਿਪੈਂਡ ਆ ਸਰਕਾਰਾਂ ਕਰ ਸਕਦੀਆਂ ਇਹ ਉਹਨਾਂ ਨੂੰ ਕਰਨ ਵਾਸਤੇ